ਇੱਕ ਵਾਰ ਅਸੀਂ ਜੰਗਲ ਦੇ ਵਿੱਚ ਗਏ ਉੱਥੇ ਅਸੀਂ ਬਹੁਤ ਭਿਆਨਕ ਜੰਗਲ ਸੀ ਉੱਥੇ ਅਸੀਂ ਗਵਾਚ ਗਏ ਅਸੀਂ ਫਿਰ ਰਸਤਾ ਭੁੱਲ ਗਏ ਸੀਗੇ ਚ ਅਸੀਂ ਨਿਕਲਣ ਦੇ ਵਿੱਚ ਅਸੀਂ ਤਾਰਾ ਮੰਡਲ ਦਾ ਉਪਯੋਗ ਕੀਤਾ ਸੀ ਮੈਂ ਅਸੀਂ ਨੀਚੇ ਕੁਛ ਤਸਵੀਰਾਂ ਬਣਾਈਆਂ ਜੋ ਕਿ ਇੱਕ ਨੌਰਥ ਬੈਸਟ ਵੱਲੋਂ ਜਾਂਦੀਆਂ ਸੀ ਤਾਰਾ ਮੰਡਲ ਇੱਕ ਹੈਗਾ ਜੋ ਕਿ ਨੌਰਥ ਤਾਰਾ ਜੋ ਕਿ ਘੱਟ ਹੀ ਹਿੱਲਦਾ ਜੁਲਦਾ ਹੈ ਸਾਨੂੰ ਉਸ ਦੇ ਰਾਹੀਂ ਸਹੀ ਰਸਤਾ ਮਿਲਿਆ ਫੇਰ ਅਸੀਂ ਅੱਗੇ ਜਾ ਕੇ ਫਿਰ ਅਸੀਂ ਕਨਫਿਊਜ ਹੋ ਗਏ ਕਿ ਅਸੀਂ ਕਿੱਧਰ ਜਾਈਏ ਤਾਰਾ ਮੰਡਲ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਾਨੂੰ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਅਸੀਂ ਬਹੁਤ ਹੀ ਵਧੀਆ ਤਾਰਾ ਮੰਡਲ ਦੇਖਿਆ ਤਾਰਾ ਮੰਡਲ ਦੇ ਨਾਲ ਅਸੀਂ ਵਧੀਆ ਰਸਤੇ ਲੱਭੇ ਤਾਰਾ ਮੰਡਲ ਬਹੁਤ ਹੀ ਵਧੀਆ ਚੀਜ਼ ਹੈ ਜੇ ਕੋਈ ਗਵਾਚ ਜਾਂਦਾ ਹੈ ਸੂਰਿਆ ਸੂਰਿਆ ਦੇ ਨਾਲ ਵੀ ਆਪਾਂ ਇੱਕ ਰਸਤਾ ਲੱਭ ਸਕਦੇ ਹਾਂ ਚੰਨ ਦੇ ਨਾਲ ਵੀ ਆਪਾਂ ਇੱਕ ਰਸਤਾ ਲੱਭ ਸਕਦੇ ਹਾਂ ਤਾਰਾ ਮੰਡਲ ਇੱਕ ਔਖੇ ਟਾਈਮ 'ਤੇ ਕੰਮ ਆਉਣ ਵਾਲੀ ਚੀਜ਼ ਹੈ ਤਾਰਾ ਮੰਡਲ ਬਹੁਤ ਹੀ ਵਧੀਆ ਚੀਜ਼ ਹੈ ਤਾਰਾ ਮੰਡਲ ਦੇ ਨਾਲ ਆਪਾਂ ਰਸਤਾ ਲੱਭ ਸਕਦੇ ਹਨ ਜਿੱਥੇ ਵੀ ਕੋਈ ਫਸਿਆ ਹੋਵੇ ਇੱਕ ਵਾਰ ਅਸੀਂ ਟੀ ਵੀ ਦੇ ਵਿੱਚ ਦੇਖਿਆ ਸੀ ਕਿ ਇੱਕ ਬੰਦਾ ਫਸ ਜਾਂਦਾ ਹੈ ਉਹ ਤਾਰਾ ਮੰਡਲ ਦਾ ਉਪਯੋਗ ਕਰਕੇ ਉਹ ਆਪਦਾ ਰਸਤਾ ਲੱਭਦਾ ਹੈ ਅਤੇ ਰਸਤੇ ਵਿੱਚ ਚਲਾ ਜਾਂਦਾ ਹੈ ਤਾਰਾ ਮੰਡਲ ਬਹੁਤ ਜ਼ਿਆਦਾ ਹੀ ਵਧੀਆ ਕੰਮ ਆਉਂਦਾ ਹੈ ਜੋ ਕਿ ਸਾਡੀ ਜਾਨ ਬਚਾਉਣ ਲਈ ਓੰ ਵਧੀਆ ਕੰਮ ਆਉਂਦਾ ਹੈ ਐਮਾਜੋਨ ਦੇ ਜੰਗਲਾਂ ਵਿੱਚ ਵੀ ਦੋ ਬੰਦੇ ਫਸ ਗਏ ਸੀ ਜੋ ਕਿ ਬਹੁਤ ਖਤਰਨਾਕ ਜੰਗਲ ਹੈ ਉੱਥੇ ਬੰਦੇ ਫਸ ਗਏ ਸੀ ਉਹਨਾਂ ਨੇ ਨਿਕਲਣ ਲਈ ਤਾਰਾ ਮੰਡਲ ਦਾ ਉਪਯੋਗ ਕੀਤਾ ਹੈ ਇੱਕ ਵਾਰ ਬਹੁਤ ਹੀ ਚੰਗੇ ਤਾਰਾ ਮੰਡਲ ਨਾਲ ਅਸੀਂ ਵੀ ਘਰ ਵੀਡੀਓ ਦੇਖੀ ਸੀਗੀ ਜੋ ਕਿ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਈ ਸੀ